ਭਾਰਤੀ ਮੀਡੀਆ ਸਾਡੇ ਦੇਸ਼ ਦਾ ਇੱਕ ਮਜਬੂਤ ਥੰਮ ਹੈ ਇਸ ਦੇ ਜਰੀਏ ਸਾਨੂੰ ਘਰ ਬੈਠੇ ਸਾਰੇ ਦੇਸ਼ ਅਤੇ ਵਿਦੇਸ਼ਾਂ ਦੀ ਜਾਣਕਾਰੀ ਮਿਲ ਜਾਂਦੀ ਹੈ ਇਹ ਸਮੇਂ ਸਮੇਂ ਉੱਤੇ ਖਬਰਾਂ ਸਾਨੂੰ ਜਾਣਕਾਰੀ ਪ੍ਰਦਾਨ ਕਰਦੀਆਂ ਹਨ ਇਹ ਕਹਿਣਾ ਥੋੜਾ ਮੁਸ਼ਕਿਲ ਹੈ ਕੀ ਸਾਨੂੰ ਸਹੀ ਤੱਥ ਬਾਰੇ ਜਾਣਕਾਰੀ ਦਿੰਦੀਆਂ ਹਨ ਹਰ ਟੀ ਵੀ ਚੈਨਲ ਦੀ ਹਰ ਵਿਸ਼ੇ ਉੱਤੇ ਆਪਣੀ ਆਪਣੀ ਰਾਏ ਹੁੰਦੀ ਹੈ ਕਿਉਂਕਿ ਹਰ ਚੈਨਲ ਉੱਤੇ ਅਲੱਗ ਅਲੱਗ ਲੋਕ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਆਪਣੇ ਆਪਣੇ ਵਿਚਾਰ ਹੁੰਦੇ ਹਨ ਸਾਡੇ ਦੇਸ਼ ਵਿੱਚ ਉਝ ਤਾਂ ਬਹੁਤ ਚੈਨਲ ਹਨ ਨਿਊਜ਼ ਵਾਲੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਇੰਡੀਆ ਟੀ ਵੀ ਆਜ ਤਕ ਪੀ ਟੀ ਸੀ ਨਿਊਜ਼ ਦੀਆਂ ਖਬਰਾਂ ਸੁਣਨਾ ਪਸੰਦ ਕਰਦੇ ਹਨ ਅਖਬਾਰਾਂ ਵਿੱਚ ਜੱਗ ਬਾਣੀ ਹਿੰਦੋਸਤਾਨ ਟਾਈਮਸ ਇੰਡੀਅਨ ਐਕਸਪ੍ਰੈਸ ਅਜੀਤ ਅਖਬਾਰ ਜਿਆਦਾ ਪ੍ਰਚਲਿਤ ਹਨ ਇਹਨਾਂ ਚੈਨਲਾਂ ਅਤੇ'ਅਖਬਾਰਾਂ ਵਿੱਚ ਸਹੀ ਤੱਥ ਤੇ ਢੁਕਵੀਆਂ ਖਬਰਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ